ਹੈਲੋ ਹੋਰ ਲਖਵੀਰ ਕੀ ਹਾਲ ਆ ਕੀ ਕੀ ਬਣਦਾ ਅੱਜ ਕੱਲ੍ਹ ਵਧੀਆ ਕੀ ਬਣਦਾ ਅੱਜ ਕੱਲ੍ਹ ਅੱਛਾ ਫਸਲ ਫੁਸਲ ਵਧੀਆ ਹੋ ਗਈ ਕਣਕ ਵਧੀਆ ਹੋ ਗਈ ਹੋ ਗਿਆ ਸੱਠ ਕੁ ਮਣ ਝਾੜ ਚੱਲ ਵਧੀਆ ਹੋ ਗਿਆ ਫਿਰ ਤਾਂ ਅੱਛਾ ਤੂੜੀ ਤਾੜੀ ਬਣਾ ਲਈ ਫਿਰ ਚਲੋ ਵਧੀਆ ਕਿੰਨੀਆਂ ਟਰਾਲੀਆਂ ਬਣਾ ਲਈਆਂ ਕਿੰਨੀਆਂ ਟਰਾਲੀਆਂ ਬਣਾ ਲਈਆਂ ਚੱਲ ਵਧੀਆ ਅਤੇ ਨਾਟ ਨੂਟ ਦਾ ਫਿਰ ਕਿਵੇਂ ਕੀਤਾ ਹਾਂ ਯਾਰ ਸਰਕਾਰਾਂ ਬਹੁਤ ਅੱਜ ਕੱਲ੍ਹ ਉਹ ਜੁਰਮਾਨੇ ਲਗਾ ਰਹੀਆਂ ਹੈ ਨਾ ਨਹੀਂ ਸਹੀ ਆ ਯਾਰ ਨਾਲੇ ਤਾਂ ਯਾਰ ਵਾਤਾਵਰਨ ਦੁਸ਼ਟ ਹੋ ਜਾਂਦਾ ਯਾਰ ਅੱਗ ਲਗਾਉਣ ਨਾਲ ਹੂੰ ਹੂੰ ਹੂੰ ਹੂੰ ਹੂੰ ਨਹੀਂ ਆ ਬ ਸਹੀ ਗੱਲ ਆ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਹਾਂ ਵਧੀਆ ਹੂੰ ਹੂੰ ਖਾਦ ਬਣ ਜਾਂਦੀ ਆ ਹੂੰ ਹੂੰ ਹੂੰ ਹੂੰ ਚੱਲ ਅੱਗੇ ਫਿਰ ਹੁਣ ਕੀ ਝੋਨਾ ਲਗਾਉਣਾ ਤਿਆਰੀ ਆ ਪਨੀਰੀ ਪੁਨਿਰੀ ਬੀਜਤੀ ਹਾਂ ਮੈਂ ਵੀ ਯਾਰ ਕੱਲ੍ਹ ਹੀ ਬੀਜ ਕੇ ਹਟਿਆ ਮੈਂ ਤਾਂ ਗਿਆਰਾਂ ਇੱਕੀ ਲਾਉ ਯਾਰ ਇਸ ਵਾਰੀ ਯਾਰ ਬਾਸਮਤੀ ਹਾਂ ਹਾਂ ਹਾਂ ਝਾੜ ਕਹਿੰਦੇ ਵਧੀਆ ਨਾਲੇ ਰੇਟ ਰੂਟ ਕਹਿੰਦੇ ਵਧੀਆ ਮਿਲ ਜਾਂਦਾ ਹੂੰ ਹਾਂ ਹਾਂ ਪਿਛਲੀ ਵਾਰ ਅਹੀਂ ਬਾਰਾਂ ਲਾਇਆ ਸੀ ਉਹ ਵੀ ਵਧੀਆ ਹੋ ਗਿਆ ਸੀ ਵੈਸੇ ਤਾਂ ਹੂੰ ਅੱਛਾ ਅੱਛਾ ਠੀਕ ਠੀਕ ਆ ਮੈਂ ਤਾਂ ਯਾਰ ਸਾਰੀ ਹੀ ਲਾਊ ਗਿਆਰਾਂ ਬਾਸਮਤੀ ਲਊਂਗਾ ਯਾਰ ਵਧੀਆ ਹੈ ਨਾ ਰੇਟ ਰੂਟ ਮਿਲ ਜਾਂਦਾ ਵਧੀਆ

ਹੂੰ ਹੂੰ ਹੂੰ ਹੂੰ ਔਰ ਪਾਣੀ ਪੂਣੀ ਵਧੀਆ ਥੱਲੇ ਮੋਟਰਾਂ ਦਾ ਚੱਲ ਨਹਿਰਾਂ ਨੂਰਾਂ ਦਾ ਪਾਣੀ ਆਉਂਦਾ ਆਹਾ ਫਿਰ ਤਾਂ ਵਧੀਆ ਨਜ਼ਾਰਾ ਹੂੰ ਹੂੰ ਹਾਂ ਹਾਂ ਵਧੀਆ ਚੱਲ ਫਿਰ ਤਾਂ ਹੂੰ ਹੂੰ ਹੂੰ ਮੱਕੀ ਮੱਕੀ ਮੁੱਕੀ ਤਾਂ ਨਹੀਂ ਬੀਜੀ ਫਿਰ ਬੀਜੀ ਆ ਅੱਛਾ ਮੈਂ ਤਾਂ ਯਾਰ ਮੱਕੀ ਨਾਲੋਂ ਕੀ ਆਪਣੀ ਦੂਜੀ ਮੂੰਗੀ ਬੀਜਤੀ ਕਹਿੰਦੇ ਕਿੱਲੇ ਕਿੱਲੇ ਦੀ ਜੀ ਤੀਹ ਤੀਹ ਚਾਲੀ ਹਜ਼ਾਰ ਦੀ ਹੋ ਜਾਂਦੀ ਕਿੱਲੇ ਦੀ ਨਾਲੇ ਉਦੋਂ ਆਹ ਬਾਸਮਤੀ ਲੱਗ ਜਾਵੇਗੀ ਵਧੀਆ ਹੂੰ ਹੂੰ ਹਾਂ ਹਾਂ ਹਾਂ ਹਾਂ ਹੂੰ ਹਾਂ ਹਾਂ ਫਿਰ ਹੁਣ ਤਾਂ ਸਰਕਾਰ ਕਹਿ ਰਹੀ ਆ ਮੂੰਗੀ ਦੇ ਆਪਣੇ ਦੇ ਰਹੀ ਆ ਐਮ ਐਸ ਪੀ ਦੇ ਰਹੀ ਆ ਵਧੀਆ ਚੱਲ ਰੇਟ ਰੂਟ ਮਿਲ ਜਾਂਦਾ ਹੂੰ ਹੂੰ ਹੂੰ ਚਲੋ ਹੂੰ ਚਲੋ ਠੀਕ ਆ ਫਿਰ ਓਕੇ ਓਕੇ